ਹੈਲੋ ਸਰ ਕੀ ਹਾਲ ਹੈ ਤੁਹਾਡਾ ਵੀ ਸਰ ਮੈਂ ਇੱਕ ਐਲ ਸੀ ਡੀ ਖਰੀਦਣਾ ਚਾਹੁੰਦੀ ਹਾਂ ਅਤੇ ਉਹਦੇ ਬਾਰੇ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕਿਸ ਕੰਪਨੀ ਦੀ ਐਲ ਸੀ ਡੀ ਸਭ ਤੋਂ ਵਧੀਆ ਕਿਸਮ ਐਲ ਸੀ ਡੀ ਹੈ ਵੀ ਕਿਵੇਂ ਦੀ ਕੰਪਨੀ ਦੀ ਐਲ ਸੀ ਡੀ ਖਰੀਦਣੀ ਚਾਹੀਦੀ ਆ ਮੈਂ ਆਨਲਾਈਨ ਖਰੀਦਾਂ ਜਾਂ ਆਫਲਾਈਨ ਖਰੀਦਾਂ ਹਾਂਜੀ ਸਰ ਹਾਂਜੀ ਅੱਛਾ ਹਾਂਜੀ ਹਾਂਜੀ ਹਾਂਜੀ ਸੈਮਸੋਂਗ ਦੀ ਠੀਕ ਹੈ ਸਰ ਹਾਂਜੀ ਪਰ ਸਰ ਮੇਰੀ ਇੱਛਾ ਸੀ ਵੀ ਮੈਂ ਥੋੜ੍ਹੀ ਜਿਹੀ ਸਮਾਰਟ ਹੋਵੇ ਵਾਈਫਾਈ ਚਲਦਾ ਹੋਵੇ ਫੋਟੋ ਸਾਫ਼ ਆਉਂਦੀ ਹੋਵੇ ਅਤੇ ਵੋਲਿਊਮ ਪ੍ਰੋਪਰ ਸੁਣਦਾ ਹੋਵੇ ਵੀ ਮੈਨੂੰ ਕੋਈ ਵੀ ਨਾਲ ਐਕਸਟਰਾ ਵੀ ਮੈਨੂੰ ਕੋਈ ਵੀ ਐਕਸਟਰਾ ਹੈਡਫੋਨ ਵਗੈਰਾ ਜਾਂ ਡੀਜੇ ਵਗੈਰਾ ਲਾਉਣ ਦੀ ਜ਼ਰੂਰਤ ਨਾ ਪਵੇ ਵੀ ਪ੍ਰੋਪਰ ਆਵਾਜ਼ ਆਉਂਦੀ ਹੋਵੇ ਅਤੇ ਫੋਰ ਕੇ ਐਲ ਈ ਡੀ ਹੋਵੇ ਸਰ ਤੁਹਾਨੂੰ ਪਤਾ ਵੀ ਬੱਚਿਆਂ ਨੂੰ ਵਧੀਆ ਲੱਗਦੀ ਆ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਬੱਚਿਆਂ ਨੂੰ ਵੀ ਜ਼ਿਆਦਾ ਹੁੰਦਾ ਹੈਗਾ ਵੀ ਟੀ ਵੀ ਵਗੈਰਾ ਦਾ ਅਤੇ ਲੇਡੀਜ ਨੂੰ ਹੁੰਦਾ ਹਾਂਜੀ ਸਰ ਹਾਂਜੀ ਵੀ ਹੁਣ ਤਾਂ ਕਾਫੀ ਤਰ੍ਹਾਂ ਦੀਆਂ ਐਲ ਸੀ ਡੀ ਚੱਲ ਰਹੀਆਂ ਪਰ ਮੈਨੂੰ ਸੀ ਵੀ ਸਭ ਤੋਂ ਵਧੀਆ ਐਲ ਸੀ ਡੀ ਹੋਵੇ ਵੀ ਜਿਹੜੀ ਲੱਗੀ ਵੀ ਸੋਹਣੀ ਲੱਗੇ ਅਤੇ ਵੀ ਵੀ ਜਚੇ ਵੀ ਕਮਰੇ ਵਿੱਚ ਵੀ ਸਰ ਮੈਂ ਇਹ ਵੀ ਚੈੱਕ ਕਰਵਾਉਣਾ ਸੀਗਾ ਵੀ ਮੇਰੇ ਨਾ ਵੋਲਟ ਵਿੱਚ ਪੈਸੇ ਵੀ ਪਏ ਨਾਲ ਵੀ ਇਹ ਚੈੱਕ ਕਰਵਾਏ ਕਰਵਾ ਲੂੰ ਕਰਵਾਏ ਜਾਣਗੇ ਵੀ ਉਹ ਕਿਹੜੀ ਬੈਂਕ ਨਾਲ ਅਟੈਚ ਆ ਅਤੇ ਮੇਰਾ ਫੋਨ ਵੀ ਕਿਸ ਨਾਲ ਅਟੈਚ ਆ ਹਾਂਜੀ ਸਰ ਹਾਂਜੀ ਹਾਂ ਸਰ ਸੈਮਸੌਂਗ ਵੀ ਠੀਕ ਆ ਬੱਚਿਆਂ ਲਈ ਵੀ ਠੀਕ ਆ ਵੇਖਣ ਵਿੱਚ ਵੀ ਸੋਹਣੀ ਲੱਗੇ ਅਸੀਂ ਵੀ ਹੁਣ ਨਵੇਂ ਮਕਾਨ ਵਿੱਚ ਸਿਫਟ ਹੋਏ ਆਂਗੇ ਵੀ ਉਹਦੇ ਲਈ ਦੋ ਐਲ ਸੀ ਡੀ ਦੀ ਰਿਕੁਆਇਰਮੈਂਟ ਸੀਗੀ ਇੱਕ ਤਾਂ ਮੈਂ ਤੁਹਾਡੇ ਨਾਲ ਹੁਣ ਗੱਲ ਕਰਕੇ ਵੀ ਪੁੱਛ ਕੇ ਆਰਡਰ ਕਰ ਰਹੀ ਹਾਂ ਅਤੇ ਮੈਨੂੰ ਵੀ ਚੰਗੀ ਲੱਗੀ ਤਾਂ ਵੀ ਮੈਂ ਇੱਕ ਆਉਣ ਵਾਲੇ ਦਿਨਾਂ ਵਿੱਚ ਵੀ ਆਰਡਰ ਕਰਾਂਗੀ ਹਾਂਜੀ ਸਰ ਹਾਂਜੀ ਮੈਨੂੰ ਵੀ ਬਿਆਲੀ ਇੰਚੀ ਐਲ ਸੀ ਡੀ ਹੋਵੇ ਹਾਂ ਸਰ ਜਿੱਥੇ ਵੀ ਅਸੀਂ ਮਕਾਨ ਲਿਆ ਉਹਦੇ ਨੇੜੇ ਤੇੜੇ ਚੋਰੀ ਚਕਾਰੀ ਵੀ ਬਹੁਤ ਜ਼ਿਆਦਾ ਹੋ ਰਹੀ ਆ ਮੈਨੂੰ ਇੱਦਾਂ ਸੀ ਵੀ ਇੱਕ ਸੀ ਸੀ ਟੀ ਵੀ ਕੈਮਰਿਆਂ ਲਈ ਵੀ ਇੱਕ ਹੋਰ ਐਲ ਸੀ ਡੀ ਲਈ ਜਾਵੇ ਪੀ ਜਿਸ 'ਤੇ ਪਲੇ ਵੀ ਆਉਂਦੀ ਰਹੇ ਵੀ ਘਰ ਦੀ ਨਿਗਰਾਨੀ ਵੀ ਰਹਿ ਸਕਦੀ ਆ ਇਸ ਲਈ ਵੀ ਤੁਸੀਂ ਵੀ ਮੈਨੂੰ ਵੀ ਕਮਰੇ ਵਿੱਚ ਲੱਗੀ ਸੋਹਣੀ ਵੀ ਲੱਗੀ ਐਲ ਸੀ ਡੀ ਵੀ ਐਵੇਂ ਦੀ ਐਲ ਸੀ ਡੀ ਚਾਹੀਦੀ ਸੀ ਮੈਨੂੰ ਹਾਂਜੀ ਸਰ ਹਾਂਜੀ ਵੀ ਐਲ ਸੀ ਡੀ ਦਾ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਗੀਆਂ ਵੀ ਕਿਉਂਕਿ ਅੱਜ ਕੱਲ੍ਹ ਜਮਾਨੇ ਦੇ ਨਾਲ ਵੀ ਤਕਨੀਕਾਂ ਵੱਧਦੀਆਂ ਜਾਂਦੀਆਂ ਹੈਗੀਆਂ ਨਿੱਤ ਨਵੇਂ ਤੋਂ ਨਵੀਂ ਐਲ ਸੀ ਡੀ ਆਉਂਦੀਆਂ ਹੈਗੀ ਅਤੇ ਉਹਦੇ ਵਿੱਚ ਵੀ ਸਾਰੇ ਫ਼ੀਚਰਸ ਹੋਣ ਵੀ ਜਦੋਂ ਵੀ ਆਪਾਂ ਉਹਨੂੰ ਫੋਨ ਅਟੈਚ ਕਰਨਾ ਹੋਵੇ ਹਾਂਜੀ ਸਰ ਫੋਨ ਅਟੈਚ ਕਰਨਾ ਹੋਵੇ ਵਾਈਫਾਈ ਕਰਨਾ ਹੋਵੇ ਜਾਂ ਕੋਈ ਵੀ ਮੂਵੀ ਵਗੈਰਾ ਦੇਖਣੀ ਹੋਵੇ ਵੀ ਉਵੇਂ ਤਰ੍ਹਾਂ ਦੀ ਐਲ ਸੀ ਡੀ ਵੀ ਸਭ ਤੋਂ ਵਧੀਆ ਐਲ ਸੀ ਡੀ ਹੋਵੇ ਅਤੇ ਵੀ ਗਰੰਟੀ ਹੋਵੇ ਕੋਈ ਸਾਲ ਦੀ ਹਾਂਜੀ ਸਰ

ਹਾਂਜੀ ਵੀ ਫੋਟੋ ਕਲੀਅਰ ਆਉਂਦੀ ਹੋਵੇ ਵੀ ਅਤੇ ਬਤਾਲੀ ਇੰਚੀ ਹੋਵੇ ਹਾਂਜੀ ਵੀ ਚਿਪ ਪਾ ਕੇ ਕੋਈ ਵੀ ਮੂਵੀ ਦੇਖ ਸਕੀਏ ਅਸੀਂ ਵੀ ਵੀ ਜਲਦੀ ਜਲਦੀ ਖ਼ਰਾਬ ਨਾ ਹੁੰਦੀ ਹੋਵੇ ਐਵੇਂ ਦੀ ਐਲ ਸੀ ਡੀ ਦੀ ਜ਼ਰੂਰਤ ਸੀਗੀ ਸਾਨੂੰ ਵੀ ਰਿਤ ਜਦੋਂ ਵੀ ਆਪਾਂ ਬਾਜ਼ਾਰ ਜਾਂ ਵਗੈਰਾ ਵਿੱਚ ਜਾਂਦੇ ਆਗੇ ਬਾਜ਼ਾਰ 'ਚ ਜਾਂਦੇ ਹਾਂ ਉੱਥੇ ਨਵੀਆਂ ਤੋਂ ਨਵੀਆਂ ਤਕਨੀਕਾਂ ਹੋਈਆਂ ਪਈਆਂ ਹੁੰਦੀਆਂ ਹਰ ਇੱਕ ਦਾ ਮੇਰੇ ਤੋਂ ਨਵੀਂ ਐਲ ਸੀ ਡੀ ਆਉਂਦੀ ਹੈਗੀ ਅਸੀਂ ਸੈਮਸੌਂਗ ਹੋਰ ਕੰਪਨੀਆਂ ਦੀਆਂ ਐਲ ਸੀ ਡੀਆਂ ਵੀ ਦੇਖੀਆਂ ਸੀਗੀਆਂ ਪਰ ਮੈਨੂੰ ਸਭ ਤੋਂ ਵਧੀਆ ਸੈਮਸੋਂਗ ਦੀ ਐਲ ਸੀ ਡੀ ਲੱਗੀ ਸੈਮਸੋਂਗ ਦੀ ਕੰਪਨੀ ਬਹੁਤ ਵਧੀਆ ਹੈਗੀ ਅਸੀਂ ਕਾਫੀ ਪਹਿਲਾਂ ਵੀ ਐਲ ਸੀ ਡੀ ਖਰੀਦੀ ਸੈਮਸੋਂਗ ਦੀ ਵੀ ਉਹ ਬਹੁਤ ਵਧੀਆ ਕੁਆਲਿਟੀ ਦੀ ਨਿਕਲੀ ਹੈ ਵੀ ਨਾ ਤਾਂ ਉਹ ਵੀ ਖ਼ਰਾਬ ਵੀ ਨਹੀਂ ਹੋਏਗੀ ਹਾਂਜੀ ਸਰ ਅਸੀਂ ਹੋਰ ਮਤਲਬ ਹੋਰ ਆਨਲਾਈਨ ਸ਼ੋਪਿੰਗ ਕਰਨ ਵਾਲੇ ਫਲਿਪਕਾਰਟ ਤੋਂ ਸੋਚਿਆ ਸੀ ਹੋਰ ਵੀ ਕਈ ਵੇਖੇ ਸੀ ਪਰ ਮੈਨੂੰ ਇਸ ਕੰਪਨੀ ਦੀ ਐਲ ਸੀ ਡੀ ਵਧੀਆ ਲੱਗੀ ਅਤੇ ਬਾਕੀ ਜਿਹੜੇ ਤੁਸੀਂ ਦੱਸਿਆ ਵੀ ਸਾਨੂੰ ਇਸ ਤਰ੍ਹਾਂ ਦੀ ਕੰਪਨੀ ਦੀ ਐਲ ਸੀ ਡੀ ਖ਼ਰੀਦਣੀ ਚਾਹੀਦੀ ਹੈ ਵੀ ਇਹ ਸਭ ਤੋਂ ਵਧੀਆ ਤਾਂ ਸਰ ਵੀ ਇਹ ਮੈਂ ਆਰਡਰ ਕਰ ਰਹੀ ਹਾਂ ਵੀ ਪ੍ਰੋਪਰ ਫੋਟੋ ਆਵੇ ਫਲੋ ਫੋਟੋ ਵਿੱਚ ਕੋਈ ਬਲਿੰਕ ਵਗੈਰਾ ਨਾ ਹੋਵੇ ਰੁਕੇ ਨਾ ਫੋਟੋ ਪੋ ਫੋਟੋ ਵਧੀਆ ਪੋਜ ਹੋਵੇ ਹਾਂਜੀ ਸਰ ਐਵੇਂ ਦੀ ਐਲ ਸੀ ਡੀ ਚਾਹੀਦੀ ਸੀ ਥੈਂਕ ਯੂ ਸਰ ਥੈਂਕ ਯੂ